ਮੇਰੇ ਹਿਸਾਬ ਮੇਰੇ ਹਿਸਾਬ ਨਾਲ ਫੋਟੋਗ੍ਰਾਫਰ ਦਾ ਰੋਲ ਕਾਫੀ ਹੀ ਸਿਗਨੀਫਿਕੈਂਟਲੀ ਵੱਧ ਚੁੱਕਿਆ ਹੈ ਅੱਜ ਦੇ ਟਾਈਮ ਵਿੱਚ ਕਿਉਂਕਿ ਟੈਕਨੋਲੋਜੀ ਦੇ ਵਿੱਚ ਬਹੁਤ ਵਾਧਾ ਹੋਇਆ ਤਾਂ ਕਰਕੇ ਸੋਸਾਇਟੀ ਵੀ ਕਾਫੀ ਚੇਂਜ ਹੋ ਗਈ ਆ ਜਿਹਦੇ ਕਰਕੇ ਸੁਸਾਇਟੀ ਵੀ ਬਹੁਤ ਜ਼ਿਆਦਾ ਕੈਮਰਾਜ਼ ਵੱਖਰੀ ਯੂਜ ਕਰਦੇ ਡੇਲੀ ਬੇਸਿਸ 'ਤੇ ਫੋਟੋਜ ਕਲਿੱਕ ਕਰਨ ਲਈ ਜੇ ਆਪਾਂ ਫੋਟੋਗ੍ਰਾਫਰਸ ਦਾ ਰੋਲ ਦੇਖੀਏ ਤਾਂ ਉਹਨਾਂ ਦਾ ਰੋਲ ਵੀ ਕਾਫੀ ਚੇਂਜ ਹੋਇਆ ਜਿਵੇਂ ਕਿ ਉਹ ਪਹਿਲਾਂ ਨਾਰਮਲ ਕੈਮਰਾਸ ਸਿਵ ਫਿਲਮ ਯੂ ਯੂਸ ਕਰਦੇ ਸੀਗੇ ਕੈਪਚਰ ਕਰਨ ਲਈ ਅੱਜ ਦੇ ਟਾਈਮ 'ਚ ਡਿਜੀਟਲ ਕੈਮਰਾ ਯੂਜ ਕਰ ਰਹੇ ਆ ਸਮਾਰਟਫੋਨ ਯੂਜ ਕਰ ਰਹੇ ਆ ਇਮੇਜਸ ਕੈਪਚਰ ਕਰਨ ਲਈ ਜਿਹੜਾ ਕਿ ਕਾਫੀ ਵਧੀਆ ਚੀਜ਼ ਹੈ ਅਤੇ ਉਹਨਾਂ ਦੀ ਸੋਸ਼ਲ ਮੀਡੀਆ 'ਤੇ ਉਹਨਾਂ ਦੀ ਔਨਲਾਈਨ ਪ੍ਰੈਜੰਸ ਵੀ ਕਾਫੀ ਵਧੀ ਹੋਈ ਆ ਕਿਉਂਕਿ ਉਹਨਾਂ ਦਾ ਇੱਕ ਪਾਰਟ ਆਫ ਜੋਬ ਇੱਦਾਂ ਦਾ ਬਣ ਗਿਆ ਕਿ ਉਹ ਕਾਫੀ ਆਡੀਐਂਸ ਤੱਕ ਪਹੁੰਚ ਸਕਦੇ ਆ ਸੋਸ਼ਲ ਮੀਡੀਆ ਥਰੂ ਅਤੇ ਜਿਵੇਂ ਕਿ ਇੰਸਟਾਗ੍ਰਾਮ ਹੋ ਗਿਆ ਟਿਕ ਟੋਕ ਹੋ ਗਿਆ ਉੱਥੇ ਉਹ ਕਾਫੀ ਲੋਕਾਂ ਨਾਲ ਕੌਂਪੀਟੀਟ ਕਰ ਸਕਦੇ ਆ ਆਪਦੇ ਫੋਟੋਗ੍ਰਾਫੀ ਸਕਿਲਸ ਨਾਲ ਐਜ਼ ਉਹ ਫਰੀਲਾਂਸਿੰਗ ਫੋਟੋਗ੍ਰਾਫੀ ਕਰ ਸਕਦੇ ਆ ਸਟੋਕ ਫੋਟੋਗ੍ਰਾਫੀ ਕਰਦੇ ਆ ਜਿਹਨਾਂ ਦਾ ਉਹਨਾਂ ਦੀ ਲਾਈਫ ਉਹ ਬਾ ਕਾਫੀ ਚੇਂਜ ਕਰਤੀ ਉਹ ਕਾਫੀ ਵਧੀਆ ਅਰਨ ਕਰਨ ਲੱਗ ਗਏ ਆ ਫਰੀਲਾਂਸ ਪਲੈਟਫਾਰਮਸ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਆਲਸੋ ਉਹ ਅਫੋਰਡਏਬਲ ਇਕਉਵਮੈਂਟ ਜਿਹੜੇ ਕਿ ਕਾਫੀ ਸਸਤੇ ਇਕਉਵਮੈਂਟ ਹੁੰਦੇ ਆ ਜਿਵੇਂ ਕਿ ਹਾਈ ਕੁਆਲਿਟੀ ਕੈਮਰਾ ਹੋ ਗਏ ਸਮਾਰਟਫੋਨ ਹੋ ਗਏ ਉਹਨਾਂ ਦੇ ਵਿੱਚ ਕਾਫੀ ਪਾਵਰਫੁਲ ਲੈਂਨਜ਼ਿਸ ਯੂਜ ਕਰਦੇ ਆ ਜਿਹਦੇ ਕਰਕੇ ਫੋਟੋਸ ਬਹੁਤ ਸੋਹਣੀਆਂ ਆਉਂਦੀਆਂ ਅੱਜ ਦੇ ਟਾਈਮ 'ਚ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਗਿਆ ਲੋਕਾਂ ਲਈ ਵੀ ਵਧੀਆ ਲੈਨਸ ਨਾਲ ਫੋਟੋਜ ਕਲਿੱਕ ਕਰਨੀਆਂ ਅਦਰਵਾਈਜ ਹੋਰ ਵੀ ਸੋਫਟਵੇਅਰ ਹੈਗੇ ਆ ਜਿਹਦੇ ਕਰਕੇ ਕਾਫੀ ਚੇਂਜ ਆਇਆ ਫੋਟੋਗ੍ਰਾਫ ਜਿਵੇਂ ਕਿ ਅਡੋਬ ਫੋਟੋਗਰਾਫ ਹੈਗਾ ਇੱਕ ਐਪ ਉਹਦੇ ਵਿੱਚ ਵੀ ਕਾਫੀ ਫੋਟੋਗ੍ਰਾਫਰਸ ਫੋਟੋ ਐਡਿਟ ਕਰਦੇ ਆ ਓਵਰਆਲ ਮੇਰਾ ਇਹ ਕਹਿਣਾ ਹੈ ਕਿ ਟੈਕਨੋਲੋਜੀ ਕਰਕੇ ਕਾਫੀ ਲੋਕ ਫੋਟੋਗ੍ਰਾਫਰਜ ਲਾਈਵ ਚੇਂਜ ਹੋਈ ਆ ਅਤੇ ਜਿਹਦੇ ਕਰਕੇ ਉਹ ਆਪਦੀ ਸੈਲਫ ਮਾਰਕੀਟਿੰਗ ਨਵੀਂ ਇਨੋਵੇਸ਼ਨ ਕਰਦੇ ਆ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਕੰਪੀਟੀਸ਼ਨ ਆ ਇਹਦੇ ਵਿੱਚ ਕਿਉਂਕਿ ਹਰ ਕੋਈ ਕੈਮਰਾ ਯੂਜ ਕਰਦਾ ਡੇਲੀ ਲਾਈਫ ਦੇ ਵਿੱਚ ਸੋ ਆਈ ਥਿੰਕ ਫੋਟੋਗ੍ਰਾਫਰ ਜਿਹੜਾ ਰੋਲ ਆ ਉਹ ਸਿਰਫ ਪਿਚਰ ਲੈਣ ਨਾਲ ਹੀ ਆ ਬਲਕਿ ਇੱਕ ਸਟੋਰੀ ਟੈਲਰ ਵੀ ਹੁੰਦਾ ਇੱਕ ਐਡੀਟਰ ਹੁੰਦਾ ਇੱਕ ਡਿਜੀਟਲ ਮਾਰਕੀਟ ਹੁੰਦਾ ਬਹੁਤ ਰੋਲ ਹੁੰਦੇ ਆ ਉਹਨਾਂ ਦੇ